ਅਸੀਂ ਸਭ ਤੋਂ ਪਹਿਲਾਂ ਕਿਤੇ ਘੁੰਮਣ ਗਏ ਅਸੀਂ ਅੰਮ੍ਰਿਤਸਰ ਦੇ ਵਿੱਚ ਘੁੰਮਣ ਗਏ ਪਹਿਲਾਂ ਅਸੀਂ ਅੰਮ੍ਰਿਤਸਰ ਦੇ ਵਿੱਚ ਘੁੰਮਣ ਗਏ ਅਤੇ ਉੱਥੇ ਅਸੀਂ ਬਹੁਤ ਕੁਛ ਦੇਖਿਆ ਪਰ ਉੱਥੇ ਬਜ਼ਾਰ ਦੇ ਵਿੱਚ ਬਹੁਤ ਜ਼ਿਆਦਾ ਸਮਾਨ ਮਹਿੰਗਾ ਸੀ ਜਿਵੇਂ ਕਿ ਸਾਡੇ ਬਠਿੰਡਾ ਦੇ ਵਿੱਚ ਜੁੱਤੀਆਂ ਉੰਨੀਆਂ ਸਸਤ ਮਹਿੰਗੀਆਂ ਨਹੀਂ ਮਿਲਦੀਆਂ ਤਾਂ ਅਸੀਂ ਉੱਥੇ ਦੇਖਿਆ ਫਿਰ ਉਸ ਤੋਂ ਬਾਅਦ ਉੱਥੇ ਰਹਿਣ ਦੇ ਰਹਿਣ ਦੇ ਲਈ ਹੋਟਲ ਕਮਰੇ ਬਹੁਤ ਜ਼ਿਆਦਾ ਮਹਿੰਗੇ ਸੀ ਤਾਂ ਅਸੀਂ ਕੀ ਕੀਤਾ ਅਸੀਂ ਪਹਿਲਾਂ ਸਾਰਿਆਂ ਤੋਂ ਪਹਿਲਾਂ ਬਜਟ ਆਪਣਾ ਦੇਖਿਆ ਕਿ ਅਸੀਂ ਕਿੰਨੇ ਅਸੀਂ ਪੰਜ ਹਜ਼ਾਰ ਦੇ ਵਿੱਚ ਪੂਰਾ ਦਿਨ ਉੱਥੇ ਰਹਿਣਾ ਸੀ ਤਾਂ ਅਸੀਂ ਦੋ ਦਿਨਾਂ ਦਾ ਹਾਂ ਪੰਜ ਹਜ਼ਾਰ ਦੇ ਵਿੱਚ ਇੱਕ ਕਮਰਾ ਲਿੱਤਾ ਪਹਿਲਾਂ ਅਸੀਂ ਦੋ ਹਜ਼ਾਰ ਦਾ ਕਮਰਾ ਲਿੱਤਾ ਤਿੰਨ ਹਜ਼ਾਰ ਅਸੀਂ ਬਚਾਇਆ ਤਿੰਨ ਹਜ਼ਾਰ ਦੇ ਵਿੱਚ ਅਸੀਂ ਆਪਣੇ ਖਾਣ ਪੀਣ ਦਾ ਪ੍ਰਬੰਧ ਕੀਤਾ ਇਸ ਐਵੇਂ ਕਰਕੇ ਅਸੀਂ ਆਪਣੇ ਬਜਟ ਨੂੰ ਮੈਨਟੇਨ ਕੀਤਾ ਅਤੇ ਫਿਰ ਅਸੀਂ ਜਦੋਂ ਘੁੰਮਣ ਗਏ ਤਾਂ ਉੱਥੇ ਸਾਰਾ ਹੀ ਖਰੀਦਣ ਵਾਲਾ ਸਮਾਨ ਜੋ ਕਿ ਬਹੁਤ ਮਹਿੰਗਾ ਸੀ ਤਾਂ ਉਸ ਸਮਾਨ ਨੂੰ ਖਰੀਦਣ ਦੇ ਲਈ ਸਾਡਾ ਬਜਟ ਨਹੀਂ ਸੀ ਇੰਨਾ ਤਾਂ ਇਸ ਕਰਕੇ ਅਸੀਂ ਉਹ ਸਮਾਨ ਜੋ ਸੀ ਨਹੀਂ ਖਰੀਦਿਆ ਤਾਂ ਅਸੀਂ ਉਸ ਤੋਂ ਬਾਅਦ ਚੰਡੀਗੜ੍ਹ ਜਾਣਾ ਸੀ ਤਾਂ ਚੰਡੀਗੜ੍ਹ ਦੇ ਵਿੱਚ ਰਸਤੇ ਦੇ ਵਿੱਚ ਅਸੀਂ ਇਹ ਬਹੁਤ ਸਾਰੀਆਂ ਜਗ੍ਹਾ 'ਤੇ ਰੁਕੇ ਪਰ ਉੱਥੇ ਵੀ ਅਸੀਂ ਕੋਈ ਸਮਾਨ ਨਹੀਂ ਖਰੀਦਿਆ ਚੰਡੀਗੜ੍ਹ ਦੇ ਵਿੱਚ ਜਾ ਕੇ ਸਾਨੂੰ ਕਈ ਜਗ੍ਹਾ 'ਤੇ ਸਮਾਨ ਸਹੀ ਲੱਗਿਆ ਤਾਂ ਸਾਡੇ ਬਜਟ ਦੇ ਵਿੱਚ ਆਇਆ ਤਾਂ ਅਸੀਂ ਲੈ ਲਿਆ